ਕਲਾ ਜਾਂ ਆਰਟ ਇਹ ਜ਼ਿੰਦਗੀ ਵਿੱਚ ਕਲਾ ਦੀ ਅਹਿਮੀਅਤ ਕੀ ਹੈ ਇਸਦੀ ਜ਼ਿੰਦਗੀ ਵਿੱਚ ਕਲਾ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਇਹ ਹਮੇ ਸਾਨੂੰ ਮਨੁੱਖ ਨੂੰ ਬਿਹਤਰ ਜ਼ਿੰਦਗੀ ਜੀਣ ਵਿੱਚ ਮਦਦ ਕਰਦਾ ਹੈ ਅਤੇ ਸਮਾਜ ਵਿੱਚ ਸਭ ਤੋਂ ਉੱਚਾ ਉੱਠਣ ਦੀ ਕੋਸ਼ਿਸ਼ ਕਰਦਾ ਹੈ ਅਤੇ ਵਧੀਆ ਜ਼ਿੰਦਗੀ ਜੀਣ ਵਿੱਚ ਮਹੱਤਵ ਕਰਦਾ ਹੈ ਕੋਈ ਵੀ ਕਲਾ ਸਿੱਖਣ ਨਾਲ਼ ਵਿਦਿਆਰਥੀਆਂ ਅਤੇ ਆ ਆਦਮੀ ਦੇ ਜੀਵਨ ਵਿੱਚ ਕਾਫ਼ੀ ਤਰ੍ਹਾਂ ਦੇ ਪ੍ਰਭਾਵ ਪੈਂਦੇ ਹਨ ਅਤੇ ਇਹ ਜ਼ਿੰਦਗੀ ਵਿੱਚ ਮਨੁੱਖੀ ਮਿਆਰ ਨੂੰ ਉੱਚਾ ਚੁੱਕਣ ਵਿੱਚ ਮਦਦ ਕਰਦੇ ਹਨ ਅਤੇ ਕਿਸੇ ਕਲਾ ਨੂੰ ਉਹ ਵੀ ਉੱਚਾ ਚੁੱਕਣ ਵਿੱਚ ਮਦਦ ਕਰਦੇ ਹਨ